ਮੈਂ ਆਪਣੇ ਛੋਟੇ ਭਰਾ ਨੂੰ ਇੱਕ ਵਾਰ ਗੇਮਿੰਗ ਕਨਸੋਲ ਲੈ ਕੇ ਦੇਣ ਦੀ ਸੋਚ ਰਿਹਾ ਸੀ ਅਤੇ ਮੈਂ ਉਸ ਨੂੰ ਆਨਲਾਈਨ ਆਰਡਰ ਵੀ ਕਰ ਦਿੱਤਾ ਪਰ ਜਿਹੜੀ ਕੰਪਨੀ ਦਾ ਮੈਂ ਆਰਡਰ ਕੀਤਾ ਉਹ ਉਸ ਨੂੰ ਨਹੀਂ ਚਾਹੀਦਾ ਸੀ ਫਿਰ ਮੈਂ ਉਸ ਨੂੰ ਆਨਲਾਈਨ ਵੈਬਸਾਈਟ ਤੋਂ ਰੱਦ ਕਰਨ ਦਾ ਫਾਰਮ ਭਰਦਾ ਭਰਨ ਭਰਦਾ ਪਿਆ ਸੀ ਅਤੇ ਆਰਡਰ ਦੇ ਵੇਰਵੇ ਵਿੱਚ ਮੈਂ ਰੱਦ ਕਰਨ ਦਾ ਕਾਰਨ ਇਹੀ ਦੱਸਿਆ ਕਿ ਵੀ ਮੈਨੂੰ ਹੁਣ ਇਹ ਆਰਡਰ ਨਹੀਂ ਚਾਹੀਦਾ ਹੈ ਅਤੇ ਉਹ ਕਿਸੇ ਹੋਰ ਨੇ ਉਸ ਨੂੰ ਕਿਸੇ ਹੋਰ ਕੰਪਨੀ ਦਾ ਯਾਨੀ ਕਿ ਆਰਡਰ ਚਾਹੀਦਾ ਸੀ ਅਤੇ ਇਸ ਕਰਕੇ ਹੁਣ ਸਾਨੂੰ ਇਸ ਦੀ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਮੇਰਾ ਆਰਡਰ ਕੈਂਸਲ ਕਰ ਦਿੱਤਾ ਜਾਵੇ ਧੰਨਵਾਦ ਜੀ